ਸਤਿ ਸ਼੍ਰੀ ਅਕਾਲ ਜੀ ਪੰਜਾਬੀ ਜਿਹੜੀ ਹੈ ਪੰਜਾਬ ਦੀ ਮੁੱਖ ਭਾਸ਼ਾ ਹੈ ਪੰਜਾਬੀ ਮਾਝੇ ਮਾਲਵੇ ਅਤੇ ਦੁਆਬੇ ਵਿੱਚ ਖਾਸ ਤੌਰ 'ਤੇ ਬੋਲੀ ਜਾਂਦੀ ਹੈ ਮਾਝੇ ਵਿੱਚ ਠੇਠ ਪੰਜਾਬੀ ਹੈ ਮਾਲਵੇ ਵਿੱਚ ਮਲਵਈ ਹੈ ਅਤੇ ਦੁਆਬੇ ਵਿੱਚ ਦੁਆਬੀ ਭਾਸ਼ਾ ਬੋਲੀ ਜਾਂਦੀ ਹੈ ਪੰਜਾਬੀ ਸਮੇਂ ਦੇ ਨਾਲ਼ ਨਾਲ਼ ਹਿਮਾਚਲ ਪ੍ਰਦੇਸ਼ ਜਿਵੇਂ ਚੌਥੇ ਪੁਆਧੀ ਪੰਜਾਬੀ ਬੋਲੀ ਜਾਂਦੀ ਹੈ ਪੰਜਾਬੀ ਬਹੁਤ ਹੀ ਦਿਨੋਂ ਦਿਨ ਵਿਕਸਿਤ ਹੋ ਰਹੀ ਹੈ ਜਿਵੇਂ ਅੱਜ ਕੱਲ੍ਹ ਦਿੱਲੀ ਵਿੱਚ ਵੀ ਪੰਜਾਬੀ ਨੂੰ ਪੜ੍ਹਨਾ ਲਿਖਣਾ ਸੁਣਨਾ ਪਸੰਦ ਕਰਦੇ ਹਨ ਇਸ ਤੋਂ ਇਲਾਵਾ ਪੰਜ ਭਾਰਤ ਦੇ ਵਿੱਚ ਹੀ ਪੰਜਾਬੀ ਜਿਹੜੀ ਹੈ ਯੂਪੀ ਇੱਥੇ ਵਾਲੀ ਸਾਈਡ ਵੀ ਬਹੁਤ ਬੋਲੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬੀ ਜਿਹੜੀ ਹੈ ਝਾਰਖੰਡ ਇਹ ਇਹਨਾਂ ਏਰੀਆਂ 'ਚ ਵੀ ਸਿੱਖਦੇ ਹੈ ਹਨ ਇਹ ਸਿੱਖਾਂ ਤੋਂ ਇਲਾਵਾ ਵੀ ਇਹ ਪੰਜਾਬ ਦੀ ਮੁੱਖ ਭਾਸ਼ਾ ਹੈ ਵਿੱਚ ਗਿਣੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬੀ ਜਿਹੜੀ ਹੈ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਵਿਕਸਿਤ ਹੋ ਰਹੀ ਹੈ ਅੱਜ ਕੱਲ੍ਹ ਦੇ ਅਜੋਕੇ ਵ ਯੁੱਗ ਵਿੱਚ ਜਿਵੇਂ ਕਨੇਡਾ ਵਰਗਾ ਦੇਸ਼ ਉੱਥੇ ਪੰਜਾਬੀ ਬਹੁਤ ਵਿਕਸਿਤ ਹੋ ਰਹੀ ਆ ਉਹਨਾਂ ਦੀ ਉਪਭਾਸ਼ਾ 'ਚ ਗਿਣੀ ਜਾਂਦੀ ਹੈ ਇਸ ਤਰ੍ਹਾਂ ਆਸਟ੍ਰੇਲੀਆ ਜਿਹੜਾ ਵਾ ਉੱਥੇ ਵੀ ਪੰਜਾਬੀ ਜਿਹੜੀ ਆ ਉਪਭਾਸ਼ਾ ਵਿੱਚ ਗਿਣੀ ਜਾਣੀ ਸ਼ੁਰੂ ਹੋ ਚੁੱਕੀ ਹੈ ਪੰਜਾਬੀ ਜਿਹੜੀ ਹੈ ਅਮਰੀਕਾ ਇੰਗਲੈਂਡ ਵਾਲੀ ਸਾਈਡ 'ਤੇ ਵੀ ਬਹੁਤ ਅੱਜ ਕੱਲ੍ਹ ਪ੍ਰਸਿੱਧ ਹੋ ਰਹੀ ਹੈ ਪੰਜਾਬੀ ਨੂੰ ਸਿੱਖਣ ਦੇ ਬਹੁਤ ਲੋਕ ਚਾਹਵਾਨ ਹਨ ਪੰਜਾਬੀ ਜਿਹੜੀ ਹੈ ਖਾਸ ਤੌਰ 'ਤੇ ਸਰਲ ਭਾਸ਼ਾ ਵਿੱਚ ਗਿਣੀ ਜਾਂਦੀ ਹੈ ਇਸ ਦੀ ਜਿਹੜੀ ਈ ਈ ਉਪਭਾਸ਼ਾ ਦੇ ਅੱਖਰ ਹਨ ਉਹ ਬੜੇ ਹੀ ਨਰਮ ਅਤੇ ਸਰਲ ਸੁਭਾਅ ਵਾਲੇ ਹਨ ਇਸਨੂੰ ਬੋਲਣ 'ਚ ਬਹੁਤ ਹੀ ਮਾਣ ਸਤਿਕਾਰ ਅਤੇ ਇੱਜ਼ਤ ਪ੍ਰਾਪਤ ਹੁੰਦਾ ਹੈ ਅਤੇ ਅਗਲਿਆਂ ਨੂੰ ਵੀ ਇਸ ਭਾਸ਼ਾ ਨਾਲ਼ ਬਹੁਤ ਹੀ ਖਿਚਾਓ ਪ੍ਰਾਪਤ ਹੁੰਦਾ ਹੈ ਕਿਉਂਕਿ ਇਸ ਵਿੱਚ ਜੀ ਹਜ਼ੂਰ ਸ਼ਬਦ ਬਹੁਤ ਹਨ ਸਾਹਿਬਾਨ ਜੇ ਜਿਹਨਾਂ ਨਾਲ਼ ਲੋਕਾਂ ਨੂੰ ਆਦਰ ਪ੍ਰਣਾਮ ਸਾਬਤ ਹੁੰਦਾ ਹੈ ਪੰਜਾਬੀ ਖਾਸ ਕਰਕੇ ਪੇਂਡੂ ਵਰਗ ਵਿੱਚ ਗੂੜ੍ਹੀ ਪੰਜਾਬੀ ਬੋਲੀ ਜਾਂਦੀ ਹੈ ਠੇਠ ਪੰਜਾਬੀ ਜਿਹਨੂੰ ਆਪਾਂ ਜਿਵੇਂ ਅੱਗੇ ਜਾਣਾ ਹੋਈਏ ਅਤੇ ਉਹਨੂੰ ਅਗਾੜੀ ਕਹਿੰਦੇ ਹਨ ਪਿੱਛੇ ਮੁੜਨਾ ਹੋਵੇ ਤਾਂ ਉਹਨਾਂ ਨੂੰ ਪਿਛਾੜੀ ਕਹਿੰਦੇ ਹਨ ਇਸ ਤਰ੍ਹਾਂ ਦੇ ਲਫ਼ਜ਼ ਵਰਤੇ ਜਾਂਦੇ ਹਨ ਮੂਹਰੇ ਹੋ ਜਾਂ ਸਾਈਡ 'ਤੇ ਹੋਣਾ ਨਹੀਂ ਕਹਿੰਦੇ ਹਨ ਜਿਵੇਂ ਕਹਿੰਦੇ ਹਨ ਮੂਹਰੇ ਹੋ ਜਾ ਇਸ ਤਰ੍ਹਾਂ ਪੰਜਾਬੀ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਤਰ੍ਹਾਂ ਦੇ ਅੱਖਰ ਵਰਤੇ ਜਾਂਦੇ ਹਨ ਪੰਜਾਬੀ ਬਹੁਤ ਹੀ ਮਸ਼ਹੂਰ ਹੈ ਪੰਜਾਬੀ ਗੁਰਮਤਿ ਵਿੱਚੋਂ ਗੁਰਮੁਖੀ ਲਿਪੀ ਵੀ ਬਹੁਤ ਮਸ਼ਹੂਰ ਹੈ ਪੰਜਾਬੀ ਪੰਜਾਬ ਦੀ ਹੀ ਮੁੱਖ ਭਾਸ਼ਾ ਹੋਣ ਦੇ ਨਾਲ਼ ਨਾਲ਼ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵਿਕਸਿਤ ਹੋ ਰਹੀ ਹੈ ਬਸ ਸਤਿ ਸ਼੍ਰੀ ਅਕਾਲ ਜੀ